ਹਾਂਜੀ ਯੋਗਾ ਦੇ ਵਿੱਚ ਜਿਹੜਾ ਪਸੰਦੀਦਾ ਆਸਣ ਹੈ ਨਾ ਉਹ ਹਰ ਵਿਅਕਤੀ ਦੇ ਵੱਖਰਾ ਵੱਖਰਾ ਹੁੰਦਾ ਉਹ ਕਿਹੜੇ ਵਿਅਕਤੀਗਤ ਤਰਜੀਹਾਂ ਸਰੀਰਕ ਸਮਰਥਾਵਾਂ ਅਤੇ ਉਸ ਸਮੇਂ ਦੀਆਂ ਜ਼ਰੂਰਤਾਂ 'ਤੇ ਨਿਰਭਰ ਕਰਦਾ ਹੈਗਾ ਕੋਈ ਇੱਕ ਆਸਣ ਹੈਗਾ ਜੋ ਸਾਰਿਆਂ ਦੀ ਸਭ ਤੋਂ ਵਧੀਆ ਹੋਵੇ ਤਾਂ ਅਜਿਹਾ ਕੋਈ ਵੀ ਆਸਣ ਨਹੀਂ ਹਾਲਾਂਕਿ ਕੁਝ ਆਸਣ ਜੋ ਬਹੁਤ ਸਾਰੇ ਲੋਕਾਂ ਨੂੰ ਪਸੰਦ ਹੁੰਦੇ ਹਨ ਅਤੇ ਠੀਕ ਹੈ ਬਹੁਤ ਸਾਰਿਆਂ ਨੂੰ ਪਸੰਦ ਆਉਂਦੇ ਆ ਪਰ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਕਿਹੜਾ ਆਸਨ ਜ਼ਿਆਦਾ ਪਸੰਦ ਹੈਗਾ ਤਾਂ ਮੈਨੂੰ ਜਿਹੜਾ ਸ਼ਵ ਅਸਾਨ ਜਿਹੜਾ ਆਸਣ ਹੈਗਾ ਇਹ ਬਹੁਤ ਵਧੀਆ ਲੱਗਦਾ ਕਿਉਂ ਵਧੀਆ ਲੱਗਦਾ ਮੈਨੂੰ ਕਿਉਂਕਿ ਜਿਹੜਾ ਇਹ ਆਸਣ ਹੈਗਾ ਯੋਗਾ ਸੈਂਸ ਜਿਹੜਾ ਸੈਸ਼ਨ ਆਪਣਾ ਉਹਦੇ ਅੰਤ ਦੇ ਵਿੱਚ ਕੀਤਾ ਜਾਂਦਾ ਹੈਗਾ ਇਹ ਸਰੀਰ ਅਤੇ ਮਨ ਨੂੰ ਆਰਾਮ ਕਰਨ ਦੇ ਵਿੱਚ ਜਿਹੜੀ ਸਾਡੀ ਮਦਦ ਕਰਦਾ ਹੈਗਾ ਕਿਉਂਕਿ ਕੁਝ ਆਸਨ ਦੂਜਿਆਂ ਨਾਲੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਠੀਕ ਹੈ ਅਤੇ ਇਹ ਜਿਹੜਾ ਆਸਣ ਇਹਦੇ ਮੈਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈਗਾ ਠੀਕ ਹੈ ਕਿਉਂਕਿ ਇਹਦੀ ਮੇਰੀ ਸਾਰੀ ਥਕਾਵਟ ਨਾ ਵੀ ਸਾਰਾ ਜਿਹੜਾ ਯੋਗਾ ਕਰਨ ਤੋਂ ਬਾਅਦ ਸਰੀਰਕ ਥਕਾਵਟ ਨੂੰ ਮੇਰੀ ਨੂੰ ਸਾਰੀ ਨੂੰ ਇਹ ਦੂਰ ਦੂਰ ਕਰਦਾ ਹੈਗਾ ਜਿਹੜਾ ਮੇਰਾ ਇਹ ਵਾਲਾ ਆਸਣ ਹੈ ਨਾ ਸਵ ਸ਼ਾਣ ਆਸਣ ਹੈ ਨਾ ਕਰੋਸ ਪੋਜ ਇਹਨੂੰ ਬੋਲਦੇ ਹੈਗੇ ਅਸੀਂ ਇੰਗਲਿਸ਼ ਦੇ ਵਿੱਚ ਤਾਂ ਜਿਹੜਾ ਕਿ ਮੈਨੂੰ ਮੇਰੇ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਦਿੰਦਾ ਵੀ ਇਸ ਲਈ ਮੈਨੂੰ ਇਹ ਬਹੁਤ ਜ਼ਿਆਦਾ ਪਸੰਦ ਹੈ